ਸਤਿ ਸ਼੍ਰੀ ਅਕਾਲ ਭਾਅ ਜੀ ਮੇਰਾ ਨਾਮ ਰਾਹੁਲ ਲਲੋਤਰਾ ਹੈ ਅਤੇ ਮੈਂ ਤੁਹਾਡੇ ਵੈੱਬਸਾਈਟ ਦੇ ਥਰੂ ਇੱਕ ਅੋਰਡਰ ਕੀਤਾ ਸੀ ਮੇਰਾ ਅੋਡਰ ਨੰਬਰ ਦੋ ਦੋ ਛੂਨੇ ਛੂਨੇ ਇੱਕ ਛੇ ਸੱਤ ਅੱਠ ਪੰਜ ਚਾਰ ਹੈ ਇਹ ਅੋਰਡਰ ਮੈਂ ਆਪਣੇ ਮੁੰਡੇ ਦੇ ਜਨਮਦਿਨ ਲਈ ਕੀਤਾ ਹੈ ਮੇਰੇ ਅੋਰਡਰ ਦੇ ਵਿੱਚ ਚਾਰ ਬਟਰ ਨਾਨ ਦੋ ਦਾਲ ਅਤੇ ਦੋ ਪਨੀਰ ਹੈ ਇਸ ਦਾ ਕੁਛ ਟੋਟਲ ਪੰਦਰਾਂ ਸੌ ਰੁਪਇਆ ਬਣਿਆ ਹੈ ਪਰ ਜਿੱਦਾਂ ਮੇਰਾ ਪ੍ਰੋਬਲਮ ਇਹ ਆ ਰਹੀ ਹੈ ਕਿ ਮੇਰਾ ਓਟੋਪੇਅ ਆਪਣੇ ਆਪ ਚਲ ਪਿਆ ਹੈ ਮੈਂ ਇਹ ਚਾਹੁੰਦਾ ਹਾਂ ਕਿ ਮੇਰਾ ਓਟੋਪੇਅ ਹਟਾਇਆ ਜਾਏ ਹਾਂਜੀ ਭਾਅ ਜੀ ਮੈਂ ਓਟੋਪੇਅ ਆਪਣਾ ਹਟਾਉਣਾ ਚਾਹੁੰਦਾ ਹਾਂ ਕਿਰਪਾ ਤੁਸੀਂ ਮੈਨੂੰ ਦੱਸੋ ਮੈਂ ਕਿੱਦਾਂ ਹਟਾ ਸਕਾਂ

ਹਾਂਜੀ ਭਾਅ ਜੀ ਮੈਨੁਊ ਵਾਲਾ ਅੋਪਸ਼ਨ 'ਤੇ ਮੈਂ ਚਲ ਗਿਆ ਹਾਂ ਹਾਂਜੀ ਮੈਨੂੰ ਆਪਣਾ ਅੋਰਡਰ ਲੱਭ ਰਿਹਾ ਹੈ ਜੀ ਮੈਂ ਅੋਰਡਰ 'ਤੇ ਕਲਿੱਕ ਕਰ ਤਾ ਹਾਂਜੀ ਸਾਈਡ 'ਤੇ ਪੇਮੈਂਟ ਦਾ ਵੀ ਅੋਪਸ਼ਨ ਲੱਭ ਰਿਹਾ ਹੈ ਹਾਂਜੀ ਉਤੇ ਓਟੋਪੇਅ ਵੀ ਲੱਭ ਰਿਹਾ ਇੱਥੇ ਮੈਂ ਹੁਣ ਕਲਿੱਕ ਕਰਦਾ ਹਾਂਜੀ ਭਾਅ ਜੀ ਮੈਂ ਕਰ ਤਾ ਹਾਂਜੀ ਭਾਅ ਜੀ ਰੱਦ ਕਰਨ ਦਾ ਅੋਪਸ਼ਨ ਲੱਭ ਰਿਹਾ ਠੀਕ ਆ ਭਾਅ ਜੀ ਮੈਂ ਕਰ ਤਾ ਰੱਦ ਹੋ ਗਿਆ ਰੱਦ ਭਾਅ ਜੀ ਹੁਣ ਤਾਂ ਨਹੀਂ ਹੋਊਗਾ ਦੁਬਾਰਾ ਓਟੋਪੇਅ ਠੀਕ ਹੈ ਭਾਅ ਜੀ ਧੰਨਵਾਦ ਭਾਅ ਜੀ ਤੁਹਾਡਾ